ਭਾਰਤ ਰਾਜ ਹੀ ਭੋਜਨ ਲਈ ਪ੍ਰਸਿੱਧ ਹੈ ਭਾਰਤ ਦੇ ਹਰ ਇੱਕ ਰਾਜ ਵਿੱਚ ਵੱਖ ਵੱਖ ਤਰ੍ਹਾਂ ਦਾ ਭੋਜਨ ਬਣਾਇਆ ਜਾਂਦਾ ਹੈ ਭਾਰਤ ਦੇ ਲਗਭਗ ਅਠਾਈ ਰਾਜ ਹਨ ਅਤੇ ਅਠਾਈ ਰਾਜਾਂ ਦੇ ਭੋਜਨ ਦੇ ਮਾਮਲੇ ਦੇ ਵਿੱਚ ਆਪਣੀਆਂ ਵੱਖ ਵੱਖ ਪ੍ਰਸਿੱਧੀਆਂ ਹਨ ਅਤੇ ਭਾਰਤ ਦਾ ਭੋਜਨ ਕਾਫੀ ਜ਼ਿਆਦਾ ਹੈਲਦੀ ਹੁੰਦਾ ਹੈ ਇਸ ਵਿੱਚ ਘਿਓ ਮਸਾਲੇ ਭਰ ਭਰ ਕੇ ਭਰੇ ਜਾਂਦੇ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਜੇ ਅਸੀਂ ਵੇਖੀਏ ਤਾਂ ਰਾਜਸਥਾਨ ਵਿੱਚ ਦਾਲ ਬਾਟੀ ਚੂਰਮਾ ਫੇਮਸ ਹੈ ਪੰਜਾਬ ਵਿੱਚ ਹਰੀਆਂ ਸਬਜ਼ੀਆਂ ਸਾਗ ਛੋਲੇ ਭਟੂਰੇ ਇਹੋ ਜਿਹੇ ਖਾਣੇ ਪ੍ਰਸਿੱਧ ਹਨ ਇਸ ਤਰ੍ਹਾਂ ਵੱਖ ਵੱਖ ਰਾਜਾਂ ਵਿੱਚ ਵੱਖ ਵੱਖ ਤਰ੍ਹਾਂ ਦਾ ਭੋਜਨ ਪ੍ਰਸਿੱਧ ਹੈ ਪਰ ਭਾਰਤ ਦਾ ਭੋਜਨ ਪੌਸ਼ਟਿਕ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਮਸਾਲਿਆਂ ਦੀ ਬਹੁਤ ਬਹੁ ਮੁੱਲਤਾ ਹੁੰਦੀ ਹੈ